ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਪੂਜਾ ਢਾਬਾ ਤੋਂ ਬੋਲ ਰਹੇ ਹੋ ਸਰ ਮੈਂ ਤੁਹਾਡਾ ਬਹੁਤ ਹੀ ਕਹਿ ਲਓ ਕਿ ਬਹੁਤ ਲੰਬੇ ਸਮੇਂ ਤੋਂ ਕਸਟਮਰ ਹੈ ਮੈਂ ਤੁਹਾਡੇ ਢਾਬੇ ਤੋਂ ਬਹੁਤ ਸਾਲਾਂ ਤੋਂ ਆਪਾਂ ਕਹਿ ਲਓ ਪੂਰੀ ਫੈਮਿਲੀ ਹੀ ਤੁਹਾਡੇ ਤੋਂ ਕੁਛ ਨਾ ਕੁਛ ਖਾਂਦੇ ਰਹਿੰਦੇ ਹਾਂ ਹੈ ਨਾ ਸੋ ਸ਼ਹਿਰ ਦੇ ਵਿੱਚ ਤੁਹਾਡਾ ਬਹੁਤ ਅੱਛਾ ਨਾਮ ਹੈ ਜੋ ਕਿ ਸਾਰਿਆਂ ਨੂੰ ਸਾਨੂੰ ਪਤਾ ਹੈ ਬਟ ਕੁਛ ਟਾਈਮ ਪਹਿਲਾਂ ਸਰ ਤੁਹਾਡੇ ਕੁਛ ਪ੍ਰੋਬਲਮ ਕਰੇਟ ਹੋ ਰਹੀ ਹੈ ਮਤਲਬ ਪਰਟੀਕੂਲਰ ਤੁਹਾਡੇ ਵੱਲੋਂ ਨਹੀਂ ਮੈਂ ਤੁਹਾਨੂੰ ਸ਼ਿਕਾਇਤ ਕਰਨ ਨੂੰ ਇੱਕ ਫੋਨ ਕੀਤਾ ਕਹਿ ਲਓ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਕਿ ਤੁਸੀਂ ਇਹ ਥੋੜਾ ਸੈੱਟ ਕਰ ਲਓ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ ਅੱਧੇ ਘੰਟੇ ਦੇ ਅੰਦਰ ਖਾਣਾ ਪਹੁੰਚਾ ਦਿੰਦੇ ਹਾਂ ਨੋ ਡਾਊਟ ਟਾਈਮ ਤੋਂ ਪਹਿਲਾਂ ਵੀ ਆ ਰਿਹਾ ਸਾਨੂੰ ਕੋਈ ਦਿੱਕਤ ਨਹੀਂ ਬਟ ਜਿਹੜਾ ਤੁਹਾਡੇ ਡਿਲੀਵਰੀ ਬੋਏ ਹੈ ਮੁਕੇਸ਼ ਉਹ ਥੋੜ੍ਹਾ ਨਾ ਮਤਲਬ ਬੰਦਾ ਸਹੀ ਨਹੀਂ ਹੈਗਾ ਉਹਦੇ ਜਿਹੜੇ ਬਿਹੇਵੀਅਰ ਹੈ ਜੋ ਉਹਦਾ ਮਤਲਬ ਰਵੱਈਆ ਉਹ ਚੰਗਾ ਨਹੀਂ ਲੱਗ ਰਿਹਾ ਜੀ ਉਹ ਥੋੜ੍ਹੇ ਜਿਹੇ ਮਤਲਬ ਕਹਿ ਲਓ ਕਿ ਉਲਟੇ ਸਿੱਧੇ ਹੈ ਨਾ ਹਰਕਤ ਕਰਦਾ ਸੋ ਇਹ ਸਾਡੇ ਮਤਲਬ ਕਹਿ ਲਓ ਕਿ ਅਸੀਂ ਵੀ ਮਤਲਬ ਫੈਮਲੀ ਦੇ ਵਿੱਚ ਕਿਸੇ ਤਰੀਕੇ ਚੰਗੀ ਗੱਲ ਨਹੀਂ ਹੈਗੀ ਸੋ ਇਹ ਮੈਂ ਤੁਹਾਨੂੰ ਪਰਸਨਲੀ ਫੋਨ ਕਰ ਰਿਹਾ ਵੀ ਕਿ ਤੁਹਾਨੂੰ ਉਹਨਾਂ ਦੇ ਬਾਰੇ ਦੱਸਾਂ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਮਤਲਬ ਕਿ ਜਿਹੜਾ ਕਾਰੋਬਾਰ ਉਹ ਖਰਾਬ ਹੋਵੇ ਜਾਂ ਲੋਕਾਂ ਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਣ ਜਿਹੜੀਆਂ ਸਾਨੂੰ ਪੈ ਰਹੀਆਂ ਵਾ ਅਤੇ ਰਿਕੁਐਸਟ ਹੀ ਆ ਵੀ ਇਹ ਬੰਦੇ ਨੂੰ ਤੁਸੀਂ ਕਿਸ ਤਰੀਕੇ ਨਾਲ ਸਹੀ ਕਰਨਾ ਕਰ ਲਓ ਨਹੀ ਤਾਂ ਫਿਰ ਤੁਹਾਨੂੰ ਪਤਾ ਹੀ ਸਰ ਦੂਜਾ ਆਪਸ਼ਨ ਵੀ ਹੈਗਾ ਕਿ ਆਪਾਂ ਕਿਤੋਂ ਹੋਰ ਰਿਪੋਰਟ ਕਰਾਵਾਂਗੇ ਕਾਰਵਾਈ ਕਰਾਂਗੇ ਉਹਦਾ ਸਾਨੂੰ ਫ਼ਾਇਦਾ ਕੋਈ ਨਹੀਂ ਸੋ ਐਜ ਆ ਭਾਈਚਾਰੇ ਦੇ ਨਾਂ 'ਤੇ ਜਾਂ ਇੱਕੋ ਸ਼ਹਿਰ ਦੇ ਵਸਨੀਕ ਹੋਣ ਦੇ ਨਾਤੇ ਮੈਂ ਤੁਹਾਨੂੰ ਸਾਰੀ ਗੱਲ ਦੱਸ ਰਿਹਾ ਸੋ ਥੈਂਕ ਯੂ ਸਰ ਇਹਨੂੰ ਥੋੜ੍ਹਾ ਸਹੀ ਕਰ ਲਿਓ ਥੈਂਕ ਯੂ